ਮੈਨੂੰ ਕੀ ਇਹ ਦੌੜਨ ਦਾ ਸ਼ੌਂਕ ਹੈ ਜੋ ਮੈਨੂੰ ਆਪਣੇ ਫਾਦਰ ਤੋਂ ਮਿਲਿਆ ਹੈ ਮੇਰੇ ਫਾਦਰ ਜੀ ਆਰਮੀ ਵਿੱਚ ਸੀ ਉਹ ਰੋਜ਼ਾਨਾ ਰੋਜ਼ਾਨਾ ਆਰਮੀ ਅਤੇ ਆਪਣੇ ਘਰ ਵਿੱਚ ਦੌੜ ਲਗਾਉਂਦੇ ਹਨ ਅਤੇ ਆਪਣੇ ਸਰੀਰ ਨੂੰ ਤੰਦਰੁਸਤ ਰੱਖਦੇ ਹਨ ਉਨ੍ਹਾਂ ਨਾਲ ਉਨ੍ਹਾਂ ਦਾ ਸਰੀਰ ਤੰਦਰੁਸਤ ਅਤੇ ਫਿੱਟ ਰਹਿੰਦਾ ਹੈ ਇਸ ਕਰਕੇ ਮੈਂ ਵੀ ਆਪਣੇ ਫਾਦਰ ਸਾਹਿਬ ਨੂੰ ਦੇਖਦਿਆਂ ਹੋਇਆਂ ਆਪਣੇ ਸਰੀਰ ਨੂੰ ਫਿੱਟ ਫਾਟ ਰੱਖਣਾ ਚਾਹੁੰਦਾ ਹਾਂ ਅਤੇ ਦੌੜ ਲਗਾਉਂਦਾ ਹਾਂ ਮੈਂ ਸਵੇਰੇ ਉੱਠ ਕੇ ਸੁਬਹਾ ਚਾਰ ਵਜੇ ਗੇੜੇ ਦਿੰਦਾ ਹਾਂ ਅਤੇ ਪੂਰੀ ਮਿਹਨਤ ਨਾਲ ਦੌੜ ਲਗਾਉਂਦਾ ਹਾਂ ਜਿਸ ਨਾਲ ਕਿ ਹੁਣ ਮੇਰੇ ਸਰੀਰ ਵਿੱਚ ਵੀ ਮਜ਼ਬੂਤੀ ਆਉਣ ਲੱਗੀ ਹੈ ਇਸ ਕਰਕੇ ਮੈਂ ਰੋਜ਼ਾਨਾ ਹੁਣ ਆਪਣੇ ਫਾਦਰ ਅਤੇ ਜਾਂ ਆਪਣੇ ਦੋਸਤਾਂ ਨਾਲ ਦੌੜ ਲਗਾਉਂਦਾ ਹਾਂ ਅਤੇ ਕੋਈ ਅਤੇ ਸਕੂਲ ਕੰਪੀਟੀਸ਼ਨ ਵਿੱਚ ਭਾਗ ਲੈਂਦਾ ਹੈ ਅਤੇ ਜੋ ਵੀ ਹੋਰ ਕੰਮ ਆਉਂਦੇ ਹਨ ਅਤੇ ਕੰਪੀਟੀਸ਼ਨ ਹੁੰਦੇ ਹਨ ਮੈਂ ਉਨ੍ਹਾਂ ਵਿੱਚ ਹਿੱਸਾ ਲੈਂਦਾ ਹਾਂ ਅਤੇ ਕੈਂਪਾਂ ਦੇ ਵਿੱਚ ਵੀ ਮੈਂ ਕੈਂਪ ਵੀ ਲਗਾਉਂਦਾ ਹਾਂ ਅਤੇ ਜਿੱਥੇ ਵੀ ਮੈਨੂੰ ਕੋਈ ਵੀ ਕੰਮ ਕਰਨ ਦਾ ਮੌਕਾ ਮਿਲਦਾ ਹੈ ਮੈ ਉੱਥੇ ਵੀ ਆਪਣਾ ਕੰਮ ਕਰਦਾ ਹਾਂ ਕੋਂਪੀਟੀਸ਼ਨ ਲੜਨ ਲਈ ਲਈ ਮੈਨੇ ਬਹੁਤ ਮਿਹਨਤ ਕੀਤੀ ਹੈ ਅਤੇ ਮੈਂ ਆਪਣੇ ਫਾਦਰ ਸਾਹਿਬ ਨੂੰ ਦੇਖਦਾ ਹਾਂ ਜਿਵੇਂ ਕਿ ਉਹ ਵਧੀਆ ਅਫ਼ਸਰ ਹਨ ਅਤੇ ਫ ਉਹ ਆਰਮੀ ਵਿੱਚ ਲੱਗੇ ਹੋਏ ਹਨ ਉਹ ਵੀ ਇੱਕ ਚੰਗੀ ਨੌਕਰੀ ਹੈ ਇਹ ਸਰੀਰਕ ਵਿੱਚ ਲੱਗੇ ਹੋਏ ਹਨ ਉਹ ਵਧੀਆ ਤਰੀਕੇ ਨਾਲ ਦੌੜਦੇ ਹਨ ਅਤੇ ਤਾਂ ਹੀ ਉਨ੍ਹਾਂ ਨੂੰ ਨੌਕਰੀ ਪ੍ਰਾਪਤ ਮਿਥੀ ਹੈ ਅਤੇ ਮੈਂ ਹੀ ਵੀ ਆਪਣੇ ਫਾਦਰ ਸਾਹਿਬ ਨਾਲ ਮਿਲ ਕੇ ਦੌੜ ਲਗਾਉਂਦਾ ਹਾਂ ਤਾਂ ਕਿ ਮੈਨੂੰ ਵੀ ਉਨ੍ਹਾਂ ਦੀ ਤਰ੍ਹਾਂ ਇੱਕ ਵਧੀਆ ਨੌਕਰੀ ਮਿਲੇ ਇਸ ਦੌੜ ਦੌੜ ਨੂੰ ਮੈਂ ਬਹੁਤ ਅੱਗੇ ਤੱਕ ਲਿਜਾਉਣਾ ਚਾਹੁੰਦਾ ਹਾਂ ਤਾਂ ਕੀ ਹੋਰ ਸਾਰੇ ਲੋਕ ਵੀ ਇਸ ਨੂੰ ਸਮਝਣ ਅਤੇ ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਇਸ ਨਾਲ ਸਾਡਾ ਸਰੀਰ ਤੰਦਰੁਸਤ ਅਤੇ ਫਿੱਟ ਫਾਟ ਰਹਿੰਦਾ ਹੈ ਇਸ ਨਾਲ ਅਸੀਂ ਬਿਮਾਰੀਆਂ ਤੋਂ ਦੂਰ ਰਹਿੰਦੇ ਹਾਂ ਤਾਂ ਕਿ ਸਾਨੂੰ ਕੋਈ ਵੀ ਬਿਮਾਰੀ ਨਾ ਲੱਗੇ ਇਸ ਕਰਕੇ ਸਾਨੂੰ ਆਪਣਾ ਸਰੀਰ ਤੰਦਰੁਸਤ ਰੱਖਣ ਲਈ ਦੌੜ ਲਗਾਉਣੀ ਜ਼ਰੂਰੀ ਹੈ ਬੜੇ ਲੋਕ ਉਹ ਹੁੰਦੇ ਹਨ ਉਹ ਸੁਬਹਾ ਦੀ ਸੈਰ ਵਿੱਚ ਟਹਿਲਦੇ ਹਨ ਤਾਂ ਕਿ ਉਹ ਵਧੀਆ ਰਹਿੰਦੇ ਹਨ ਅਤੇ ਸੁਬਹਾ ਦੀ ਤਾਜ਼ੀ ਹਵਾ ਖਾਂਦੇ ਹਨ ਅਤੇ ਆਪਣੇ ਸਰੀਰ ਨੂੰ ਤੰਦਰੁਸਤ ਰੱਖਦੇ ਹਨ ਇਸ ਨਾਲ ਆ ਸਾਡੇ ਸਰੀਰ ਨੂੰ ਬਹੁਤ ਵਧੀਆ ਤੰਦਰੁਸਤ ਅਤੇ ਫਿੱਟ ਫਾਟ ਰਹਿੰ